ਬਚਪਨ ਵਿੱਚ ਮੈਂ ਸਕੈਚ ਦੀ ਮਦਦ ਨਾਲ ਕਾਫ਼ੀ ਅਲੱਗ ਅਲੱਗ ਤਰੀਕੇ ਦੀ ਪੇਂਟਿੰਗਸ ਬਣਾਉਂਦਾ ਸੀ ਸ਼ੁਰੂ ਤੋਂ ਹੀ ਮੇਰਾ ਇਹ ਰੁਚੀ ਅੰਦਰ ਰਿਹਾ ਸੀ ਕਿ ਮੈਂ ਕਲਾ ਤੇ ਸ਼ਿਲਪਕਾਰੀਆਂ ਦਾ ਕੁਛ ਕਰਾਂ ਮੈਨੂੰ ਸ਼ੁਰੂ ਤੋਂ ਇੰਟ੍ਰਸਟ ਸੀਗਾ ਟੀਚਰ ਦੀ ਮੈਨੂੰ ਕਹਿੰਦੇ ਸੀ ਕਿ ਤੁਸੀਂ ਇਸ ਚੀਜ ਅੰਦਰ ਅੱਗੇ ਜਾ ਸਕਦੇ ਹੋ ਮੈਂ ਬਚਪਨ ਵਿੱਚ ਕਾਫ਼ੀ ਦੇਖੇ ਜਿਵੇਂ ਕੀ ਆ ਪੇੜ ਹੋ ਗਏ ਫੁੱਲ ਹੋ ਗਏ ਪੱਤੇ ਹੋ ਗੇ ਜਾਨਵਰ ਪੰਛੀ ਸਭ ਤਰੀਕੇ ਦੇ ਮੈਂ ਬਨਾ ਕੇ ਕੋਸ਼ਿਸ਼ ਕਰਦਾ ਸੀ ਮੇਰਾ ਬਹੁਤ ਈ ਜਿਆਦਾ ਇੰਟ੍ਰਸਟ ਸੀ ਤੇ ਮੈਨੂੰ ਐਨ ਦੇ ਜਦੋਂ ਕਰਦਾ ਸੀ ਮੈਨੂੰ ਸਮੇਂ ਦਾ ਪਤਾ ਈ ਨੀ ਚੱਲਦਾ ਸੀ ਕਿ ਮੇਰਾ ਸਮੇ ਕਦੋਂ ਲੰਘ ਗਿਆ ਐ ਤੇ ਇਹਦੀ ਮਦਦ ਨਾਲ ਸਾਡੇ ਟੀਚਰਸ ਨੇ ਸਾਨੂੰ ਸਿਖਾਇਆ ਸੀ ਕਿ ਤੁਸੀਂ ਆਪਦੇ ਘਰ ਦੇ ਅੰਦਰ ਕਿਵੇਂ ਡੈਕੋਰੇਸ਼ਨਸ ਕਰ ਸਕਦੇ ਓ ਜਿਵੇਂ ਕਿ ਤੁਸੀਂ ਪੇਂਟਿੰਗਸ ਬਣਾ ਕੇ ਉਹਨੂੰ ਦੀਵਾਰ ਤੇ ਲਾ ਸਕਦੇ ਓ ਅਲੱਗ ਅਲੱਗ ਤਰੀਕੇ ਦੀ ਦੀਵਾਰ ਤੇ ਪੇਂਟਿੰਗ ਜੀਹਦੇ ਨਾਲ ਤੁਸੀਂ ਆਪਦੇ ਘਰ ਦੇ ਅੰਦਰ ਸੋਹਣੇ ਸੋਹਣੇ ਫਲਾਵਰਸ ਬਣਾ ਤੇ ਪੇੜ ਬਣਾ ਤੇ ਸਿਨਰੀ ਬਣਾ ਕੇ ਆਪਦੀ ਦੀਵਾਰ ਦੀ ਸਜਾਵਟ ਕਰ ਸਕਦੇ ਓ ਇੱਕ ਬਹੁਤ ਈ ਸਸਤਾ ਤੇ ਵਧੀਆ ਤਰੀਕਾ ਆਪਦੇ ਘਰ ਨੂੰ ਸਜਾਉਣ ਦਾ ਐਨ ਦੀ ਮਦਦ ਨਾਲ ਅਸੀਂ ਆਪਦੇ ਘਰ ਦੇ ਅੰਦਰ ਤੇ ਅਸੀਂ ਹੋ ਸਕਦਾ ਕੀ ਜਦੋਂ ਵੀ ਕੋਈ ਫ਼ੰਕਸ਼ਨ ਹੋ ਰਿਹਾ ਸਕੂਲ ਕਾਲਜ ਦੇ ਅੰਦਰ ਅਸੀਂ ਓਥੇ ਵੀ ਇਸਦੀ ਮਦਦ ਨਾਲ ਸਜਾਵਟ ਕਰ ਸਕਦੇ ਹਾਂ ਤੇ ਐਨ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਕੀ ਆਪਦੀ ਕਲਾ ਨੂੰ ਵਿਖਾਇਆ ਜਾਏ ਕਲਾ ਅਗਰ ਕਿਸੀ ਪਰਸਨ ਅੰਦਰ ਹੈ ਉਹਨੂੰ ਸ਼ਿਲਪਕਾਰੀ ਇਸ ਚੀਜਾਂ ਅੰਦਰ ਜਰੂਰ ਕੋਸ਼ਿਸ਼ ਕਰਨੀ ਚਾਈਦੀ ਹੈ ਮੈਂ ਆਪਦੀ ਖਾਲੀ ਸਮੇਂ ਅੰਦਰ ਵੀ ਕੋਸ਼ਿਸ਼ ਕਰਦਾ ਕੁਛ ਨਾ ਕੁਛ ਬਣਾਲਵਾਂ ਜਦੋਂ ਮੈਂ ਘਰੇ ਹੁੰਨਾ ਮੇਰੇ ਕੋਲ ਖਾਲੀ ਸਮੇ ਹੁੰਦਾ ਐ ਤੇ ਮੈਂ ਕੁਛ ਨਾ ਕੁਛ ਪੇਂਟਿੰਗ ਜਾਂ ਫਿਰ ਕੁਛ ਸ਼ਿਲਪਕਾਰੀ ਕਰਨ ਦੀ ਕੋਸ਼ਿਸ਼ ਕਰਦਾ ਮੈਨੂੰ ਇਸ ਚੀਜ ਦਾ ਬਹੁਤ ਈ ਸ਼ੋਂਕ ਐ ਆਪਦੀ ਤੁਸੀਂ ਦਿਮਾਗ ਦਾ ਪੂਰਾ ਪੂਰਾ ਯੂਜ ਕਰ ਸਕਦੇ ਓ ਯੋਗਦਾਨ ਆਪਦਾ ਵਧੀਆ ਦੇ ਸਕਦੇ ਓ ਤੇ ਮੇਰਾ ਇਹ ਹੈਗਾ ਕੀ ਹਰ ਇੱਕ ਬੱਚੇ ਨੂੰ ਸ਼ਿਲਪਕਾਰੀ ਅਤੇ ਕਲਾ ਦੇ ਅੰਦਰ ਆਪਦਾ ਯੋਗਦਾਨ ਦੇਣਾ ਚਾਈਦਾ ਹੈ